ਜੀ ਹਾਂ ਮੈਂ ਇੰਡੀਅਨ ਆਈਡਲ ਵਰਕੇ ਸੰਗੀਤ ਰਿਐਲਟੀ ਸ਼ੋ ਦੇਖਦੀ ਹਾਂ ਕਿਉਂਕਿ ਮੈਨੂੰ ਵੀ ਗਾਉਣ ਦਾ ਬਹੁਤ ਸ਼ੌਂਕ ਹੈ ਮੇਰਾ ਮਨਪਸੰਦ ਭਾਗੀਦਾਰ ਸਲਮਾਨ ਅਲੀ ਸੀ ਸਲਮਾਨ ਅਲੀ ਜਿਵੇਂ ਕਿ ਬਹੁਤ ਵਧੀਆ ਗਾਉਂਦੇ ਸਨ ਸਲਮਾਨ ਅਲੀ ਇੰਡੀਅਨ ਸਿੰਗਰ ਦੇ ਵਿਜੇਤਾ ਵੀ ਰਹੇ ਸਨ ਇਹ ਸਾ ਰੇ ਗਾ ਮਾ ਪਾ ਲਿਟਲ ਚੈਂਪਸ ਦੋ ਹਜ਼ਾਰ ਗਿਆਰਾਂ ਦੇ ਰਨਰ ਅਪ ਵੀ ਰਹੇ ਸਨ ਸਲਮਾਨ ਅਲੀ ਦਾ ਜਨਮ ਹਰਿਆਣਾ ਵਿਖੇ ਹੋਇਆ ਹੈ ਸਲਮਾਨ ਅਲੀ ਦਾ ਗਾਉਣ ਦਾ ਢੰਗ ਬਹੁਤ ਹੀ ਖਰਾ ਹੈ ਇਹ ਵੋਕਲਸ ਵੀ ਗਾਉਂਦੇ ਹਨ ਅਤੇ ਕਈ ਵਿੱਚ ਕਈ ਫਿਲਮਾਂ ਵਿੱਚ ਇਹ ਪਲੇਬੈਕ ਸਿੰਗਰ ਵੀ ਰਹੇ ਹਨ ਸਲਮਾਨ ਅਲੀ ਦਾ ਸੁਰ ਬਹੁਤ ਹੀ ਵਧੀਆ ਲੱਗਦਾ ਹੈ ਇਹਨਾਂ ਨੂੰ ਜੱਜਿਸ ਵੀ ਬਹੁਤ ਹੀ ਵਧੀਆ ਸਲਾਹੁੰਦੇ ਹਨ ਇਹ ਇੱਕ ਭਾਰਤੀ ਸਿੰਗਰ ਵੀ ਰਹਿ ਚੁੱਕੇ ਹਨ